ਜੀ ਹਾਂ ਮੈਨੂੰ ਸਿਲਾਈ ਕਢਾਈ ਆਉਂਦੀ ਹੈ ਅਤੇ ਮੈਂ ਆਪਣੇ ਘਰ ਵਿੱਚ ਆਪਣੇ ਦਾਦੀ ਜੀ ਨੂੰ ਸਿਲਾਈ ਕਢਾਈ ਕਰਦੇ ਹੋਏ ਦੇਖਿਆ ਹੈ ਮੇਰੇ ਦਾਦੀ ਜੀ ਬਹੁਤ ਸੋਹਣੇ ਕੱਪੜੇ ਸੀਂਦੇ ਸਨ ਉਹ ਜਿਸ ਤਰ੍ਹਾਂ ਦਾ ਕੱਪੜਾ ਦੇਖਦੇ ਸਨ ਉਸ ਤਰ੍ਹਾਂ ਦਾ ਆਪ ਬਣਾ ਦਿੰਦੇ ਸਨ ਉਹਨਾਂ ਨੂੰ ਸਿਲਾਈ ਕਢਾਈ ਕਰਨ ਦਾ ਬਹੁਤ ਸ਼ੌਕ ਸੀ ਉਹਨਾਂ ਨੂੰ ਦੇਖ ਕੇ ਹੀ ਮੈਨੂੰ ਸਿਲਾਈ ਕਢਾਈ ਕਰਨ ਦਾ ਬਹੁਤ ਸ਼ੌਕ ਆਇਆ ਹੈ ਮੈਨੂੰ ਵੀ ਸਿਲਾਈ ਕਢਾਈ ਕਰਨੀ ਬਹੁਤ ਚੰਗੀ ਲੱਗਦੀ ਹੈ ਮੈਂ ਵੀ ਹਰ ਤਰ੍ਹਾਂ ਦਾ ਕੱਪੜਾ ਦੇਖ ਕੇ ਸੀਅ ਲੈਂਦੀ ਹਾਂ ਮੈਂ ਆਪਣੇ ਦਾਦੀ ਜੀ ਦੀ ਤਰ੍ਹਾਂ ਹੀ ਇਸ ਕੱਪੜੇ ਨੂੰ ਸੀਅ ਕੇ ਉਸ ਤਰ੍ਹਾਂ ਦਾ ਹੀ ਦੇਖ ਕੇ ਬਣਾ ਲੈਂਦੀ ਹਾਂ ਸਾਡੇ ਇਲਾਕੇ ਵਿੱਚ ਮਰਦ ਵੀ ਹੁਣ ਸਿਲਾਈ ਕਢਾਈ ਦਾ ਕੰਮ ਕਰਨ ਲੱਗ ਪਏ ਹਨ ਪਹਿਲਾਂ ਮਰਦ ਵੀ ਆਦਮੀਆਂ ਦੇ ਕੱਪੜੇ ਸੀਂਦੇ ਸਨ ਪਰ ਹੁਣ ਮਰਦ ਔਰਤਾਂ ਦੇ ਵੀ ਕੱਪੜੇ ਸੀਅ ਲੈਂਦੇ ਹਨ ਹਰ ਤਰ੍ਹਾਂ ਦੇ ਕੱਪੜੇ ਮੇਰੇ ਦਾਦੀ ਜੀ ਵੀ ਸੀਅ ਲੈਂਦੇ ਸਨ ਉਹਨਾਂ ਨੂੰ ਵੀ ਸਿਲਾਈ ਕਢਾਈ ਕਰਨੀ ਬਹੁਤ ਚੰਗੀ ਲੱਗਦੀ ਸੀ ਮੈਂ ਵੀ ਆਪਣੇ ਘਰ ਵਿੱਚ ਆਪਣੇ ਸੂਟ 'ਤੇ ਤਰ੍ਹਾਂ ਤਰ੍ਹਾਂ ਦੀ ਕਢਾਈਆਂ ਕਰ ਲੈਂਦੀ ਹਾਂ ਮੇਰੇ ਦਾਦੀ ਜੀ ਨੇ ਮੈਨੂੰ ਕਈ ਤਰ੍ਹਾਂ ਦੀ ਕਢਾਈਆਂ ਸਿਖਾਈਆਂ ਹਨ ਧਾਗੇ ਦੀ ਕਢਾਈ ਸਿਖਾਈ ਹੈ ਜੋ ਕਿ ਮੈਨੂੰ ਬਹੁਤ ਚੰਗੀ ਲੱਗਦੀ ਹੈ ਮੈਨੂੰ ਕੱਪੜੇ ਸੀਣੇ ਬਹੁਤ ਚੰਗੇ ਲੱਗਦੇ ਹਨ ਜਿਹਨਾਂ ਨੂੰ ਮੈਂ ਸੀਅ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਮੇਰੇ ਦਾਦੀ ਜੀ ਨੂੰ ਵੀ ਬਚਪਨ ਤੋਂ ਹੀ ਕੱਪੜੇ ਸੀਣ ਦਾ ਬਹੁਤ ਸ਼ੌਕ ਸੀ ਉਹਨਾਂ ਨੂੰ ਦੇਖ ਦੇਖ ਕੇ ਮੈਨੂੰ ਹੋਰ ਪ੍ਰੇਰਨਾ ਮਿਲੀ ਅਤੇ ਮੈਂ ਵੀ ਕੱਪੜੇ ਸੀਣੇ ਸ਼ੁਰੂ ਕਰ ਦਿੱਤੇ ਜਿਸ ਨੂੰ ਦੇਖ ਕੇ ਮੈਨੂੰ ਹੋਰ ਬਹੁਤ ਚੰਗਾ ਲੱਗਦਾ ਹੈ ਅਤੇ ਮੈਂ ਹੁਣ ਹੋਰ ਵੀ ਅੱਗੋਂ ਨਵੀਂ ਨਵੀਂ ਤਕਨੀਕਾਂ ਨੂੰ ਸਿੱਖਾਂਗੀ ਅਤੇ ਨਵੇਂ ਨਵੇਂ ਕੱਪੜਿਆਂ ਨੂੰ ਸਿੱਖਾਂ ਬਣਾਉਣਾ ਸਿੱਖਾਂਗੀ ਧੰਨਵਾਦ